ਮਨਪਸੰਦ ਪੌਦੇ ਕਿੱਕਰ ਟਾਹਲੀ ਇਹ ਤਾਂ ਪੇੜ ਆ ਗਏ ਪੌਦਿਆਂ ਦੇ ਵਿੱਚ ਗੁਲਾਬ ਹੈ ਗੇਂਦਾ ਹੈ ਅਤੇ ਇਹਦੇ ਨਾਲ ਹੀ ਆਪਣੇ ਮੈਂ ਆਪਣੇ ਘਰ ਦੇ ਵਿੱਚ ਵੀ ਸਜਾਵਟ ਦੇ ਤੌਰ 'ਤੇ ਅਤੇ ਕੁਦਰਤ ਨਾਲ ਪਿਆਰ ਕਰਦੇ ਹੋਏ ਵੀ ਇਹ ਜਿਹੜੇ ਪੌਦੇ ਹੈ ਛੋਟੇ ਗੁਲਾਬ ਗੈਂਦਾ ਗਲਦੋਦੀ ਇਹ ਆਪਣੇ ਘਰ ਦੇ ਵਿੱਚ ਹੀ ਗਮਲਿਆਂ ਦੇ ਵਿੱਚ ਉਗਾਏ ਹੋਏ ਹੈ ਇਹਦੇ ਨਾਲ ਹੀ ਨਾਲ ਜ਼ਮੀਨ ਹੋਣ ਕਰਕੇ ਥੋੜ੍ਹੀ ਮੈਂ ਆਪਣੇ ਉੱਥੇ ਸਬਜ਼ੀ ਦੇ ਲਈ ਆਪਣੇ ਕੱਦੂ ਭਿੰਡੀ ਤੋਰੀ ਆਦਿ ਦੀਆਂ ਵੱਲਾਂ ਲਗਾਈਆਂ ਹੋਈਆਂ ਹੈ ਕਿਉਂਕਿ ਬਾਜ਼ਾਰ ਦੇ ਵਿੱਚ ਜੋ ਸਬਜ਼ੀ ਵਗੈਰਾ ਆ ਰਹੀ ਹੈ ਮਿਲ ਰਹੀ ਹੈ ਉਹ ਕੈਮੀ ਕੈਮੀਕਲ ਹੋਣ ਦੀ ਵਰਤੋਂ ਹੋਣ ਕਰਕੇ ਜ਼ਿਆਦਾ ਸਰੀਰ ਦੇ ਲਈ ਨੁਕਸਾਨ ਦਾਇਕ ਹੋ ਰਹੀ ਹੈ ਇਸ ਲਈ ਮੈਂ ਆਪਣੇ ਤੌਰ 'ਤੇ ਆਰਗੈਨਿਕ ਤਰੀਕੇ ਨਾਲ ਆਪਣੇ ਨਾਲ ਜ਼ਮੀਨ ਲੱਗਦੀ ਜ਼ਮੀਨ ਦੇ ਵਿੱਚ ਹੀ ਘਰ ਦੇ ਲਈ ਸਬਜ਼ੀ ਵ ਵਗੈਰਾ ਅਤੇ ਉੱਥੇ ਦੋ ਰੁੱਖਾਂ ਦੇ ਰੂਪ ਦੇ ਵਿੱਚ ਛ ਛਾਂ ਦੇ ਤੌਰ 'ਤੇ ਟਾਹਲੀ ਅਤੇ ਕਿੱਕਰ ਲਗਾਏ ਹੋਏ ਹੈ ਕਿੱਕਰ ਅਤੇ ਟਾਹਲੀ ਦੀ ਜਿਹੜੀ ਦਾਤਣ ਹੈ ਉਹ ਰੂਟੀਨ ਦੇ ਵਿੱਚ ਮੈਨੂੰ ਕਰਨ ਨੂੰ ਮਿਲਦੀ ਹੈ ਜੋ ਕਿ ਡਾਕਟਰਾਂ ਦੇ ਦੱਸਣ ਮੁਤਾਬਿਕ ਬਹੁਤ ਅਜੋਕੇ ਸਮੇਂ ਦੇ ਵਿੱਚ ਬਹੁਤ ਵਧੀਆ ਹੈ ਜਿਸ ਤੋਂ ਲੋਕ ਅੱਜ ਕੱਲ ਟੁੱਟੇ ਹੋਏ ਨੇ